ਇੱਕ ਸਟੇਡੀਅਮ ਆ ਇੱਕ ਸਥਾਨ ਜੋ ਜੋ ਕਿ ਬਾਹਰੀ ਖੇਡਾਂ ਸੰਗੀਤ ਸਮਾਰੋਹ ਹੋਰ ਸਮਾਗਮਾਂ ਲਈ ਇੱਕ ਮੈਦਾਨ ਹੈ ਜਾਂ ਪੂਰੀ ਸਟੇਜ ਇੱਕ ਤਰ੍ਹਾਂ ਟਾਈਡ ਢਾਂਚੇ ਨਾ ਘਿਰਿਆ ਹੁੰਦਾ ਹੈ ਜੋ ਦਰਸ਼ਕਾਂ ਨੂੰ ਖੜ੍ਹੇ ਹੋਣ ਜਾਂ ਬੈਠਣ ਨਹੀਂ ਬੈਠਣ ਅਤੇ ਦੇਖਣ ਦੀ ਆਗਿਆ ਦੇਣ ਲਈ ਤਿਆਰ ਕੀਤਾ ਜਾਂਦਾ ਹੈ ਸਾਡੇ ਖੇਤਰ ਵਿੱਚ ਵੀ ਇੱਕ ਸਟੇਡੀਅਮ ਸਟੇਡੀਅਮ ਹੈ ਜੋ ਕਿ ਗੋਲ ਘੇਰੇ ਵਿੱਚ ਹੈ ਇਸ ਵਿੱਚ ਕਈ ਤਰ੍ਹਾਂ ਦੇ ਪ੍ਰਬੰਧ ਹਨ ਜੋ ਕਿ ਜਿਵੇਂ ਕਿ ਖਿਡਾਰੀਆਂ ਲਈ ਲਾਈਟਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਖ ਖੇਡਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਮੈਡੀਕਲ ਦਾ ਪ੍ਰਬੰਧ ਹੁੰਦਾ ਗਾ ਅਤੇ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ ਦਰਸ਼ਕਾਂ ਲਈ ਵੀ ਚਾਰੇ ਪਾਸੇ ਕੁਰਸੀਆਂ ਕੁਰਸੀਆਂ ਲਗਾਈਆਂ ਜਾਂਦੀਆਂ ਹਨ ਤਾਂ ਕਿ ਉਹਨਾਂ ਨੂੰ ਬੈਠਣ ਵਿੱਚ ਕੋਈ ਮੁਸ਼ਕਿਲ ਨਾ ਹੋਵੇ ਸਾਡੇ ਖੇਤਰ ਵਿੱਚ ਇਹ ਖੇਡਾਂ ਦੂਰੋਂ ਦੂਰੋਂ ਦੇਖਣ ਵਾਸਤੇ ਆਉਂਦੇ ਹਨ ਇਹ ਖੇਡਾਂ ਕਈ ਖੇਤਰਾਂ ਦੇ ਖਿਡਾਰੀ ਖੇਡਦੇ ਹਨ ਅਲੱਗ ਅਲੱਗ ਖੇ ਖੇਤਰਾਂ ਦੇ ਖਿਡਾਰੀ ਆਉਂਦੇ ਹਨ ਖੇਡਣ ਇਹ ਇਸ ਖੇਤਰ ਵਿੱਚ ਕਈ ਤਰ੍ਹਾਂ ਦੇ ਹੋਰ ਵੀ ਪ੍ਰੋਗ ਪ੍ਰੋਗਰਾਮ ਹੁੰਦੇ ਹਨ ਜਿਵੇਂ ਸਮਾਰੋਹ ਅ ਆਦਿ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਹਨ